ਹੈਲੋ ਹਾਂਜੀ ਠੀਕ ਹੈ ਕੁਲਜੀਤ ਜੀ ਕੀ ਹਾਲ ਆ ਠੀਕ ਹੋ ਹੋਰ ਘਰ ਪਰਿਵਾਰ ਠੀਕ ਸਭ ਜੀ ਜੀ ਤੇ ਕੁਲਜੀਤ ਜੀ ਮੈਂ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ ਸੀਗੀ ਵੀ ਮੈਂ ਇੱਕ ਲਿਖ ਰਿਹਾ ਸਕ੍ਰਿਪਟ ਹਾਂਜੀ ਮੂਵੀ ਆ ਆਪਣਾ ਮੋਟੀਵੇਸ਼ਨਲ ਮੂਵੀ ਕਹਿ ਲਓ ਜਾਂ ਹੈ ਨਾ ਸਟਰਗਲ ਟਾਈਮ ਵਾਲੀ ਮੂਵੀ ਜਿੱਦਾਂ ਦੀਆਂ ਹੁੰਦੀਆਂ ਵਾ ਆਰਟ ਮੂਵੀ ਟਾਈਪ ਬਹੁਤ ਵਧੀਆ ਸਕ੍ਰਿਪਟ ਮੇਰੇ ਦਿਮਾਗ 'ਚ ਆਈ ਹੈ ਅਤੇ ਮੈਂ ਤੁਹਾਡੀ ਸਲਾਹ ਲੈਣੀ ਸੀ ਵੀ ਮੈਂ ਲਿਖਣੀ ਸ਼ੁਰੂ ਕਰਨ ਲੱਗਾ ਸੀ ਅਤੇ ਮੈਂ ਤੁਹਾਨੂੰ ਸਟੋਰੀ ਬੇਸ ਦੱਸਦਾ ਜੀ ਸਕ੍ਰਿਪਟ ਦਾ ਹਾਂਜੀ ਗੱਲ ਇੱਦਾਂ ਸ਼ੁਰੂ ਹੁੰਦੀ ਹੈ ਵੀ ਇੱਕ ਬੰਦਾ ਹੁੰਦਾ ਗਾ ਉਹ ਮਤਲਬ ਵੀ ਸ਼ੁਰੂ ਤੋਂ ਆਪਾਂ ਕਹਿ ਲਈਏ ਜਿਹੜੇ ਬੱਚੇ ਬਹੁਤ ਜ਼ਿਆਦਾ ਗਰੀਬ ਨਹੀਂ ਹੁੰਦੇ ਘਰ ਪਰਿਵਾਰ ਵਾਲੇ ਪਾਸਿਓਂ ਘਰੋਂ ਇਹ ਉੱਥੋਂ ਸਟੋਰੀ ਸ਼ੁਰੂ ਹੁੰਦੀ ਹੈ ਕੀ ਕਹਿਣਾ ਜੀ ਤੁਹਾਡਾ ਠੀਕ ਹੈ ਨਾ ਵੀ ਮੈਂ ਇੱਥੋਂ ਸ਼ੁਰੂ ਆਪਣਾ ਬੇਸਲਾਈਨ ਆਪਣੇ ਸਟਾਰਟਿੰਗ ਇਹ ਸ਼ੁਰੂ ਕੀਤੀ ਹਾਂਜੀ ਹਾਂਜੀ ਹਾਂਜੀ ਮੇਰੀ ਮਤਲਬ ਵੀ ਹੈਗੀ ਆ ਰੀਅਲ ਸਟੋਰੀ ਬੇਸ ਕੋਈ ਐਂ ਨਹੀਂ ਵੀ ਆਪਾਂ ਕਹਿ ਦੇਈਏ ਮਨਘੜਤ ਹਾਂਜੀ ਅਤੇ ਗਰੀਬ ਪਰਿਵਾਰ ਦਾ ਬੱਚਾ ਹੁੰਦਾ ਹੈਗਾ ਅਤੇ ਛੋਟੀ ਉਮਰ ਦੇ ਵਿੱਚ ਹੀ ਮੈਂ ਮੋਟੀ ਮੋਟੀ ਤੁਹਾਨੂੰ ਸਾਰੀ ਕਹਾਣੀ ਦੱਸਦਾ ਵੀ ਉਹਦੇ ਡੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਬਹੁਤ ਕੰਮ ਕਾਰ ਕਰਦਾ ਉਹ ਕਿਵੇਂ ਨਾ ਕਿਵੇਂ ਮਾੜਾ ਮੋਟਾ ਆਪਣਾ ਘਰ ਚਲਾਈ ਜਾਂਦਾ ਰਹਿੰਦਾ ਅਤੇ ਮਾਤਾ ਹੁੰਦੀ ਹੈ ਜਿਹੜੀ ਉਸਦੀ ਅਤੇ ਉਹ ਥੋੜ੍ਹੀ ਮਤਲਬ ਵੀ ਬਜ਼ੁਰਗ ਹੁੰਦੇ ਆ ਅਤੇ ਇੱਦਾਂ ਕਰਦੇ ਕਰਾਉਂਦੇ ਫਿਰ ਘਰ ਦੇ ਕਹਿਣ ਲੱਗ ਜਾਂਦੇ ਵੀ ਵਿਆਹ ਕਰੋ ਬੱਚੇ ਦਾ ਹੈ ਨਾ ਵੀ ਉਮਰ ਬਹੁਤ ਹੋਈ ਜਾਂਦੀ ਆ ਅਤੇ ਉਹਦਾ ਕਿਵੇਂ ਨਾ ਕਿਵੇਂ ਵਿਆਹ ਹੋ ਜਾਂਦਾ ਗਾ ਅਤੇ ਘਰ ਵਾਲੀ ਉਹਦੀ ਬਹੁਤ ਵਧੀਆ ਮਤਲਬ ਵੀ ਉਹਦੇ ਨਾਲ ਕੋਆਪਰੇਟਿਵ ਹੁੰਦੀ ਆ ਵੀ ਉਹਦੇ ਹਾਲਾਤਾਂ ਨੂੰ ਸਮਝਦੀ ਹੁੰਦੀ ਆ ਜਿਸ ਕਰਕੇ ਕਿ ਨਾਲ ਉਹ ਦੋਵੇਂ ਹੱਥ ਵੰਡ ਕੇ ਇੱਕ ਦੂਜੇ ਨਾਲ ਖੜ ਕੇ ਮਤਲਬ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਹੈ ਨਾ ਵੀ ਘਰ ਚਲਾਉਣਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਵੀ ਇੱਦਾਂ ਕਹਿ ਲਓ ਵੀ ਆਪਾਂ ਸਸਪੈਂਸ ਇਹ ਕ੍ਰੀਏਟ ਕਰਨਾ ਵੀ ਇੱਕ ਕੁੜੀ ਦੇ ਆਉਣ ਕਰਕੇ ਵੀ ਘਰ ਦਾ ਮਾਹੌਲ ਆ ਜਿਹੜਾ ਚੇਂਜ ਹੋ ਗਿਆ ਇੱਕੋ ਦਮ ਹੀ ਸਾਲ ਦੋ ਸਾਲ ਦੇ ਵਿੱਚ ਵਿੱਚ ਅਤੇ ਇੱਦਾਂ ਹੀ ਉਸ ਨੂੰ ਉਸ ਬੰਦੇ ਨੂੰ ਇੱਕ ਐਪ ਬਾਰੇ ਪਤਾ ਚੱਲਦਾ ਹੈਗਾ ਉਹ ਐਪ ਯੂਜ ਕਰਦਾ ਉਹਦੇ ਵਿੱਚ ਗਰੁੱਪ ਹੁੰਦੇ ਆ ਗਰੁੱਪ ਦਾ ਐਡਮਿਨ ਉਹ ਹੁੰਦਾ ਲੋਕ ਉਹਦੇ ਵਿੱਚ ਆ ਕੇ ਗੇਮ ਖੇਡਦੇ ਆ ਅਤੇ ਗਿਫਟਿੰਗ ਕਰਦੇ ਆ ਠੀਕ ਹੈ ਇਹਦੇ ਨਾਲ ਉਹਨੂੰ ਘਰ ਬੈਠੇ ਨੂੰ ਹੀ ਪੈਸਾ ਧੇਲਾ ਬਹੁਤ ਜ਼ਿਆਦਾ ਵਧੀਆ ਆਉਣ ਲੱਗ ਜਾਂਦਾ ਉਹਨਾਂ ਦੇ ਘਰ ਦੇ ਹਾਲਾਤ ਜਿਹੜੇ ਚੇਂਜ ਹੋ ਜਾਂਦੇ ਆ ਹੈ ਨਾ ਪਰ ਉਹਨਾਂ ਦੀ ਇੱਕ ਕਮੀ ਹੁੰਦੀ ਆ ਉਹਨਾਂ ਦੀ ਲਾਈਫ ਦੇ ਵਿੱਚ ਕਿ ਉਹਨਾਂ ਦੇ ਬੇਬੀ ਨਹੀਂ ਹੁੰਦਾ ਛੇਤੀ ਸਿਰਫ਼ ਹੁਣ ਉਹਨਾਂ ਦੀ ਕਹਿੰਦੇ ਵੀ ਸਾਰੇ ਜਿਹੜੇ ਵੀ ਚੀਜ਼ ਪੂਰੀ ਹੋ ਜਾਂਦੀ ਆ ਘਾਟ ਕੋਈ ਨਹੀਂ ਰਹਿੰਦੀ ਘਰ ਚ ਵੀ ਜ਼ਰੂਰਤਾਂ ਦੀ ਹੈ ਨਾ ਪਰ ਉਹਨਾਂ ਨੂੰ ਇੱਕ ਬੱਚੇ ਦੀ ਘਾਟ ਹੁੰਦੀ ਆ ਬਸ ਉਹ ਪੂਰੀ ਨਹੀਂ ਹੁੰਦੀ ਇਹ ਆਪਾਂ ਸਸਪੈਂਸ ਰੱਖਣਾ ਇੱਕ ਹਾਂਜੀ ਹਾਂਜੀ ਹਾਂਜੀ ਉਹ ਆਪਾਂ ਮੈਂ ਤੁਹਾਨੂੰ ਤਾਂ ਹੀ ਐਂ ਕਹਿੰਦਾ ਸੀ ਵੀ ਆਪਾਂ ਇਹ ਬੈਠ ਕੇ ਡਿਸਕਸ ਕਰਾਂਗੇ ਰਾਈਟ ਡਾਊਨ ਕਰਾਂਗੇ ਆਪਾਂ ਨਿੱਕੀ ਨਿੱਕੀ ਜਿਹੀ ਕਮੀਆਂ ਵੀ ਜੋ ਆਪਾਂ ਇਹਦੇ 'ਚ ਹੋਰ ਪੋਲਿਸ਼ ਕਰ ਸਕਦੇ ਹਾਂ ਠੀਕ ਹੈ ਜੀ ਅਤੇ ਮੈਂ ਤੁਹਾਨੂੰ ਸ਼ਾਮ ਤੱਕ ਮਿਲਦਾ ਓਕੇ